ਮੇਰਾ ਨਾਮ ਗੁਰਪ੍ਰੀਤ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਪੰਜਾਬੀ ਭਾਸ਼ਾ ਨੂੰ ਮੇਰੇ ਖਿਆਲ ਨਾਲ ਬਹੁਤ ਇੱਕ ਦਿਲੋਂ ਨਿੱਜੀ ਭਾਸ਼ਾ ਹੁੰਦੀ ਹੈ ਇਹ ਸਾਡੀ ਮਾਂ ਬੋਲੀ ਹੁੰਦੀ ਹੈ ਤੁਸੀਂ ਪੁੱਛਿਆ ਤੁਸੀਂ ਕਿਵੇਂ ਸੋਚਦੇ ਹੋ ਕਿ ਪੰਜਾਬੀ ਭਾਸ਼ਾ ਦੀ ਤੁਲਨਾ ਉਹਨਾਂ ਹੋਰ ਭਾਸ਼ਾ ਨਾਲ ਕੀਤੀ ਜਾਂਦੀ ਹੈ ਤਾਂ ਤੁਸੀਂ ਜਾਣਦੇ ਹੋ ਮੇਰੇ ਖਿਆਲ ਨਾਲ ਹਿੰਦੀ ਭਾਸ਼ਾ ਇੱਕ ਅੰਤਰਰਾਸ਼ਟਰੀ ਭਾਸ਼ਾ ਹੋ ਸਕਦੀ ਹੈ ਸਾਡੇ ਦੇਸ਼ ਦੀ ਪਰ ਜੇ ਪੰਜਾਬੀ ਭਾਸ਼ਾ ਜਿੱਥੇ ਤੱਕ ਮੇਰਾ ਖਿਆਲ ਹੈ ਪੰਜਾਬੀ ਭਾਸ਼ਾ ਸਾਡੀ ਦਿਲੋਂ ਨਿਕਲਦੀ ਹੈ ਇਹ ਸਾਡੀ ਮਾਂ ਬੋਲੀ ਹੈ ਸ਼ੁਰੂ ਤੋਂ ਹੀ ਉਹਨੂੰ ਹੀ ਬੋਲਦੇ ਆਏ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਸਾਨੂੰ ਵੱਡੇ ਸਤੱਰ 'ਤੇ ਲੈ ਕੇ ਜਾਣਾ ਚਾਹੀਦਾ ਪੰਜਾਬ ਦੇ ਕਈ ਕਲਾਕਾਰ ਕਈ ਸਿੰਗਰ ਜਿਵੇਂ ਦਿਲਜੀਤ ਦੋਸਾਂਝ ਨੇ ਹੈਗੇ ਜਾਂ ਸਿੱਧੂ ਮੂਸੇਵਾਲਾ ਹੋ ਗਿਆ ਉਹ ਇੰਟਰਨੈਸ਼ਨਲ ਲੈਵਲ 'ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਗਏ ਸੀ ਪੰਜਾਬੀ ਜੋ ਹੈ ਜਦੋਂ ਕੋਈ ਪੰਜਾਬੀ ਬੋਲਦਾ ਹੈ ਤਾਂ ਉਹ ਵੱਖਰਾ ਹੀ ਲੱਗਦਾ ਹੁਣ ਤੁਸੀਂ ਬਾਹਰ ਜਾ ਜਾਓ ਮੁੰਬਈ ਜਾਂ ਦਿੱਲੀ ਵਾਲੀ ਸਾਈਡ ਉੱਥੇ ਜਿਹੜਾ ਪੰਜਾਬੀ ਆ ਉਹ ਵੱਖਰਾ ਹੀ ਦਿਸਦਾ ਹੈ ਆਪਣੀ ਪਿਆਰ ਭਾਸ਼ਾ ਨਾਲ ਬੋਲਣਾ ਉਹ ਕਿਸੇ ਨਾਲ ਵੀ ਘੁਲ ਮਿਲ ਜਾਂਦਾ ਹੈ ਪੰਜਾਬੀ ਇਕ ਇਹੋ ਜਿਹੀ ਲੈਂਗੁਏਜ ਹੈ ਜਿਹਨੂੰ ਅਸੀਂ ਬੋਲਦੇ ਨਹੀਂ ਹਾਂ ਉਹਨੂੰ ਮਹਿਸੂਸ ਕਰਦੇ ਹਾਂ ਇਹ ਦਿਲੋਂ ਨਿਕਲਦੀ ਹੈ ਇੱਕ ਅਵਾਜ਼ ਹੁੰਦੀ ਹੈ ਜੋ ਅਗਲੇ ਬੰਦੇ ਨੂੰ ਪਹੁੰਚ ਜਾਂਦੀ ਹੈ ਅਤੇ ਉਹਨੂੰ ਬਹੁਤ ਪਿਆਰ ਸਤਿਕਾਰ ਨਾਲ ਅੱਗੋਂ ਸਾਨੂੰ ਬੁਲਾਉਂਦਾ ਹੈ ਹੁਣ ਜਿਹੜੇ ਇੰਡੀਅਨ ਐਕਟਰ ਐਕਟਰਸ ਹੈ ਜਿੰਨੇ ਵੀ ਅਭਿਨੇਤਾ ਹਨ ਉਹ ਪੰਜਾਬੀ ਭਾਸ਼ਾ ਦਾ ਬਹੁਤ ਸਨਮਾਨ ਕਰਦੇ ਹਨ ਸ਼ਾਹਰੁਖ ਖਾਨ ਨੇ ਖੁਦ ਹੀ ਬੋਲਿਆ ਸੀ ਕਿ ਉਹਨਾਂ ਦਾ ਕਰੀਅਰ ਹੀ ਇੱਕ ਪੰਜਾਬੀ ਬੰਦੇ ਨੇ ਬਣਾਇਆ ਉਹਨਾਂ ਦਾ ਸੁਭਾਅ ਬਹੁਤ ਮਿੱਠਾ ਹੈ ਉਸੇ ਤਰ੍ਹਾਂ ਪੰਜਾਬੀ ਭਾਸ਼ਾ ਵੀ ਦਿਲ ਨੂੰ ਮੋਹ ਲੈਂਦੀ ਹੈ ਦਿਲ ਨੂੰ ਛੂਹ ਲੈਂਦੀ ਹੈ ਅਤੇ ਇਸੇ ਕਰਕੇ ਪੰਜਾਬੀ ਭਾਸ਼ਾ ਸਾਡੀ ਗੁਰੂਆਂ ਦੀ ਦਿੱਤੀ ਹੋਈ ਅਜਿਹੀ ਅਮੁੱਲ ਚੀਜ਼ ਹੈ ਜਿਹਨੂੰ ਅਸੀਂ ਕਦੀ ਨਹੀਂ ਭੁੱਲਾ ਸਕਦੇ ਹਮੇਸ਼ਾ ਉਸਨੂੰ ਰੱਖਦੇ